ਹੈਲੋ ਐੱਲ ਜੀ ਜੀ ਕਸਟਮਰ ਕੇਅਰ ਤੋਂ ਗੱਲ ਕਰ ਰਹੇ ਹੋ ਜੀ ਹਾਂਜੀ ਮੈਂ ਨਾ ਆਪਣਾ ਹਾਂ ਅਠਾਰਾਂ ਤਰੀਕ ਨੂੰ ਇੱਕ ਨਾ ਏ ਸੀ ਆਡਰ ਕੀਤਾ ਸੀ ਐਲ ਜੀ ਦਾ ਆਰ ਐਸ ਮਾਡਲ ਹੈ ਜੀ ਐਲ ਜੀ ਹੋਟ ਐਂਡ ਕੂਲ ਅਤੇ ਇਹਦੀ ਪਹਿਲੀ ਗੱਲ ਤਾਂ ਮੈਨੂੰ ਡਿਲੀਵਰੀ ਹੈ ਜਿਹੜੀ ਬਿਲਕੁਲ ਟਾਈਮ ਸਿਰ ਨਹੀਂ ਹੋਈ ਤਿੰਨ ਦਿਨ ਲੇਟ ਪਹੁੰਚਿਆ ਮੇਰੇ ਕੋਲ ਜਦੋਂ ਵੀ ਆਪਣਾ ਆਪਣਾ ਆਪਰੇਟਰ ਆਇਆ ਮਕੈਨਿਕ ਆਇਆ ਨਾ ਆਪਰੇਟਰ ਨੇ ਕੀ ਕਾ ਸੈਟਿੰਗ ਕਰਦੇ ਸਮੇਂ ਗੈਸ ਲੀਕੇਜ ਕਰ ਤੀ ਉਸ ਤੋਂ ਬਾਅਦ ਗੈਸ ਲੀਕੇਜ ਕਰਨ 'ਤੇ ਹੁਣ ਬਿਲਕੁਲ ਏ ਸੀ ਕੂਲਿੰਗ ਨਹੀਂ ਦੇ ਰਿਹਾ ਉਸ ਤੋਂ ਮੈਂ ਆਪਣੇ ਆਪਰੇਟਰ ਨੂੰ ਇਸ ਦੀ ਇੰਸਟਾਲ ਕਰਵਾਉਣ ਲਈ ਤਿੰਨ ਦਿਨ ਕਾਲ ਕਰਦਾ ਰਿਹਾ ਮੈਨੂੰ ਉਹਨੇ ਬਹੁਤ ਹਰਾਸ ਕੀਤਾ ਅਤੇ ਆਪਣਾ ਕੀ ਹੈ ਤਿੰਨ ਦਿਨ ਕਾਲ ਕਰਨ ਦੇ ਬਾਵਜੂਦ ਮੈਂ ਚੌਥੇ ਦਿਨ ਮੇਰੇ ਕੋਲ ਫੋਨ ਆਉਂਦਾ ਮੈਂ ਹੋਸਪਿਟਲ ਦੇ ਵਿੱਚ ਸੀ ਜਦੋਂ ਬੰਦਾ ਆਇਆ ਇੰਨੀ ਅਣਗਹਿਲੀ ਨਾਲ ਫਿਟਿੰਗ ਕਰ ਕੇ ਗਿਆ ਅਤੇ ਗੈਸ ਏ ਸੀ ਦੀ ਗੈਸ ਲੀਕੇਜ ਹੋ ਗਈ ਹੁਣ ਉੱਪਰੋਂ ਮੈਂ ਸੈਟ ਕਰਵਾਇਆ ਅਤੇ ਮੇਰਾ ਉਸ ਤੋਂ ਐਕਸਟਰਾ ਖ਼ਰਚਾ ਹੋ ਗਿਆ ਵਰ ਪਰ ਫਿਲਹਾਲ ਹੁਣ ਵੀ ਐਲ ਜੀ ਦਾ ਏ ਸੀ ਹੋਣ ਦੇ ਬਾਵਜੂਦ ਵੀ ਇਹ ਬਿਲਕੁਲ ਪ੍ਰੋਪਰ ਕੰਮ ਨਹੀਂ ਕਰ ਰਿਹਾ ਮੈਨੂੰ ਅੱਜ ਵੀ ਉਹੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਜੋ ਗਰਮੀ ਕਰਕੇ ਪਹਿਲਾਂ ਆ ਰਹੀ ਸੀ ਇਸ ਕਰਕੇ ਮੈਂ ਆਪਣੀ ਕੰਪਲੇਂਟ ਪਾਉਣੀ ਚਾਹੁੰਦਾ ਗਾ ਅਤੇ ਮੈਂ ਅੱਗੇ ਤੋਂ ਐਲ ਜੀ ਦੀ ਰਾਇ ਨਹੀਂ ਦਊਂਗਾ ਕੋਈ ਵੀ ਕਸਟਮਰ ਆ